ਪੰਜਾਬ ਦੇ ਲੋ ਲੋ ਲੋਕਾਂ ਦਾ ਰੋਗ ਅਤੇ ਦਰਦ ਮੁੱਖ ਕਾਰਨ ਇੱਕ ਤਾਂ ਉਹਨਾਂ ਦਿਲ ਦਿਲ ਦੀ ਬਿਮਾਰੀ ਦਾ ਕਾਰਨ ਹੈ ਕਿਉਂਕਿ ਉਹ ਅੱਜ ਕੱਲ੍ਹ ਕਸਰਤ ਵਾਲਾ ਮਾਹੌਲ ਨਹੀਂ ਰਿਹਾ ਪਹਿਲੇ ਕੀ ਹੁੰਦਾ ਸੀ ਕਿ ਲੋਕ ਜਿੰਨਾ ਖਾਂਦੇ ਸੀ ਉਸ ਤੋਂ ਜ਼ਿਆਦਾ ਕਸਰਤ ਕਰਦੇ ਸੀ ਪਰ ਅੱਜ ਦੇ ਟਾਈਮ ਦੇ ਵਿੱਚ ਅੱਜ ਕੰਮ ਰਹਿ ਗਿਆ ਸਿਰਫ ਕੁਰਸੀ 'ਤੇ ਬਹਿ ਕੇ ਕਰਨ ਦਾ ਮੋਬਾਈਲ 'ਤੇ ਲੈਪਟੋਪ 'ਤੇ ਲੋਕ ਕੰਮ ਕਰਦੇ ਹਨ ਪਰ ਹੁਣ ਵਰਜ਼ਸ ਜਿਹੜੀ ਹੈ ਉਹ ਘੱਟ ਗਈ ਹੈ ਜਿਹਦੇ ਕਾਰਨ ਕਿ ਖੂਨ ਦੇ ਵਿੱਚ ਚਿਕਨਾਹਟ ਵੱਧ ਗਈ ਹੈ ਅਤੇ ਉੱਥੇ ਨਾੜੀਆਂ ਦੇ ਵਿੱਚ ਬਲੋਕੇਜ ਆ ਜਾਂਦੀ ਹੈ ਜਿਹਦੇ ਕਾਰਨ ਹਾਰਟ ਅਟੈਕ ਹੋਣ ਦਾ ਕਾ ਕਾਰਨ ਵੱਧ ਜਾਂਦੇ ਹਨ ਅਤੇ ਅਤੇ ਇਸ ਟੈਨਸ਼ਨ ਵੀ ਬਹੁਤ ਹੋ ਗਈ ਹੈ ਕੰਮ ਕਾਰ ਦੇ ਵਿੱਚ ਟੈਂਸ਼ਨ ਕੀ ਹੈ ਕਿ ਕ ਕਾਰੋਬਾਰ ਘੱਟ ਜਾਂ ਮਾਰਜਨ ਘਟੀ ਜਾਂਦਾ ਹੈ ਜਿਹਦੇ ਕਰਕੇ ਲੋਕ ਬਹੁਤ ਜ਼ਿਆਦਾ ਤੰਗ ਰਹਿੰਦੇ ਹਨ ਅਤੇ ਸਟਰੈਸ ਲੈਣ ਲੱਗ ਪੈਂਦੇ ਹਨ ਜਿਹਦੇ ਕਰਕੇ ਦਿਮਾਗ 'ਤੇ ਪ੍ਰੈਸ਼ਰ ਪੈਂਦਾ ਹੈ ਅਤੇ ਦਿਮਾਗ ਦੇ ਵਿੱਚ ਸਟੋਕ ਹੋਣ ਦਾ ਵੀ ਕਾਰਨ ਵੱਧ ਜਾਂਦਾ ਹੈ ਇਸ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ ਵਾਸਤੇ ਹੀ ਲੋਕਾਂ ਨੂੰ ਆਪਣਾ ਰਹਿਣ ਸਹਿਣ ਠੀਕ ਕਰਨਾ ਚਾਹੀਦਾ ਹੈ ਧੰਨਵਾਦ